ਹਾਂਜੀ ਫ਼ਰਨੀਚਰ ਵਾਲੀ ਸ਼ੋਪ ਤੋਂ ਬੋਲਦੇ ਹੋ ਜੀ ਹਾਂਜੀ ਅਸੀਂ ਨਾ ਤੁਹਾਡੇ ਤੋਂ ਬੈੱਡ ਲੈ ਕੇ ਗਏ ਸੀ ਅਸੀਂ ਲੈ ਕੇ ਗਏ ਸੀਗੇ ਥੋੜ੍ਹੇ ਦਿਨ ਹੋ ਗਏ ਉਦੋਂ ਲੈ ਕੇ ਗਏ ਸੀ ਹਾਂਜੀ ਉਹ ਅਸੀਂ ਮਤਲਬ ਉਹਦੇ ਜਿਹੜੇ ਬੋਕਸ ਸੀਗੇ ਉਹ ਛੋਟੇ ਰਹਿ ਗਏ ਆ ਸਮਾਨ ਰੱਖਣ ਵਿੱਚ ਦਿੱਕਤ ਆਉਂਦੀ ਹੈਗੀ ਇੱਕ ਥੋੜ੍ਹਾ ਜਿਹਾ ਮਤਲਬ ਛੋਟਾ ਹੈਗਾ ਲੰਬਾਈ 'ਚ ਨਹੀਂ ਹੈਗਾ ਪੈਣ 'ਚ ਵੀ ਦਿੱਕਤ ਆਉਂਦੀ ਹੈਗੀ ਅਤੇ ਜਿਹੜਾ ਢੋਅ ਹੈਗਾ ਉਹ ਵੀ ਛੋਟਾ ਹੁੰਦਾ ਢੋਅ ਦੇ ਵਿੱਚ ਜਿਹੜੇ ਰੱਖਣੇ ਉਹ ਵੀ ਛੋਟੇ ਹੈਗੇ ਆ ਅਤੇ ਲਾਈਟਿੰਗ ਵਗੈਰਾ ਉਹ ਵੀ ਥੋੜ੍ਹੀ ਖ਼ਰਾਬ ਜਿਹੀ ਹੈਗੀ ਹੈ ਅਸੀਂ ਚੇਂਜ ਕਰਵਾਉਣਾ ਜੀ ਹਾਂਜੀ ਹਾਂਜੀ ਤੇ ਮਤਲਬ ਬੈੱਡ ਇਸ ਇਸ ਡਿਜ਼ਾਈਨ ਦੇ ਵਿੱਚ ਹੋਰ ਬੈੱਡ ਮਿਲ ਜਾਵੇਗਾ ਜੀ ਹਾਂਜੀ ਜੇ ਉਸ ਤਰ੍ਹਾਂ ਦਾ ਡਿਜ਼ਾਈਨ ਨਾ ਹੋਇਆ ਤਾਂ ਫਿਰ ਅਸੀਂ ਸਾਈ 'ਤੇ ਬਣਵਾ ਸਕਦੇ ਹਾਂ ਹਾਂਜੀ

ਹਾਂਜੀ ਹਾਂਜੀ

ਠੀਕ ਹੈ ਜੀ ਇੱਕ ਮਤਲਬ ਬੈੱਡ ਦੀ ਲੱਕੜ ਥੋੜ੍ਹੀ ਖ਼ਰਾਬ ਨਿੱਕਲੀ ਸੀਗੀ ਅਤੇ ਹੁਣ ਦੁਬਾਰਾ ਬੈੱਡ ਲੈ ਕੇ ਜਾਵਾਂਗੇ ਤਾਂ ਉਹਦੀ ਲੱਕੜ ਥੋੜ੍ਹਾ ਜਿਹਾ ਧਿਆਨ ਰੱਖਿਓ ਵੀ ਵਧੀਆ ਹੋਵੇ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਸਾਨੂੰ ਸਾਡੇ ਘਰ ਫ਼ੰਕਸ਼ਨ ਹੈ ਜੀ ਅਸੀਂ ਬੈੱਡ ਵਗੈਰਾ ਅਤੇ ਸੋਫ਼ੇ ਵਗੈਰਾ ਵੀ ਲੈਣੇ ਹੈ ਡਰੈਸਿੰਗ ਟੇਬਲ ਵਗੈਰਾ ਉਹ ਮਿਲ ਜਾਵੇਗਾ ਤੁਹਾਡੀ ਸ਼ੋਪ 'ਤੇ

ਹਾਂਜੀ ਹਾਂਜੀ ਹਾਂ ਅਲਮੀਰਾ ਕਿਸ ਤਰ੍ਹਾਂ ਦੀ ਮਿਲ ਜਾਵੇਗੀ ਜੀ ਹਾਂਜੀ ਆਪਾਂ ਨੂੰ ਵਧੀਆ ਲੱਕੜ ਦੀ ਚਾਹੀਦੀ ਹੈ ਜੀ ਅਲਮੀਰਾ ਵਧੀਆ ਲੱਕੜ ਦੀ ਹੋਵੇ ਮਜ਼ਬੂਤ ਹਾਂਜੀ ਫਿਰ ਹਾਂਜੀ ਫਿਰ ਅਸੀਂ ਕੱਲ੍ਹ ਆ ਜਾਈਏ ਹਾਂਜੀ ਫਿਰ ਅਸੀਂ ਕੱਲ੍ਹ ਐਕਸਚੇਂਜ ਕਰਵਾ ਦਾਂਗੇ ਤਾਂ ਤੁਸੀਂ ਸਾਨੂੰ ਉਹਦੀ ਜਗ੍ਹਾ 'ਤੇ ਕੋਈ ਹੋਰ ਬੈੱਡ ਦਿਖਾ ਦਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਅਸੀਂ ਕੱਲ੍ਹ ਆਵਾਂਗੇ ਐਕਸਚੇਂਜ ਕਰਵਾ ਕੇ ਲੈ ਜਾਂਗੇ ਠੀਕ ਹੈ ਤੁਸੀਂ ਕੱਢ ਕੇ ਰੱਖ ਦਿਓ ਜੇ ਦਿਖਾ ਦਿਓ ਸਾਨੂੰ

ਠੀਕ ਹੈ ਜੀ